ਸਾਡੇ ਸ਼ਹਿਰ ਨਵਾਂ ਸ਼ਹਿਰ ਵਿੱਚ ਬਹੁਤ ਸਾਰੀਆਂ ਕਲਾ ਨਾਲ ਸੰਬੰਧਿਤ ਸਟੋਰ ਹੈਗੇ ਨੇ ਜਿੱਥੋਂ ਕਿ ਬਹੁਤ ਸਾਰੀ ਕਲਾ ਕ੍ਰਿਤੀਆਂ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਇਸੇ ਤਰ੍ਹਾਂ ਸਾਡੇ ਸ਼ਰਮਾ ਜਿਹੜਾ ਅ ਸਟੋਰ ਹੈ ਇੱਥੋਂ ਅਸੀਂ ਆਪਣੇ ਅ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਕਲਾ ਕ੍ਰਿਤੀਆਂ ਖਰੀਦ ਸਕਦੇ ਹਾਂ ਜਿਸ ਤਰ੍ਹਾਂ ਸਾਨੂੰ ਰਾਈਟਿੰਗ ਦਾ ਸ਼ੌਂਕ ਹੈ ਵੱਖ ਵੱਖ ਤਰ੍ਹਾਂ ਦੇ ਪੈੱਨ ਵੱਖ ਵੱਖ ਰੰਗਾਂ ਦੇ ਇਸੇ ਤਰ੍ਹਾਂ ਨੋਟ ਬੁੱਕਸ ਵੀ ਮਿਲ ਜਾਂਦੀਆਂ ਅਤੇ ਬਾਕੀ ਪ੍ਰਿੰਟਰ ਵਿੱਚੋਂ ਕ ਨਿਕਲਣ ਵਾਲੇ ਪੇਜ ਹਰ ਤਰ੍ਹਾਂ ਦੇ ਜਿਹੜੇ ਕਾਗਜ਼ ਹੈ ਇੱਥੋਂ ਮਿਲ ਜਾਂਦੇ ਆ ਤੁਸੀਂ ਵੱਖ ਵੱਖ ਰੰਗਾਂ ਦੇ ਵੱਖ ਵੱਖ ਡਿਜ਼ਾਇਨਾਂ ਦੇ ਜਿਹੜੇ ਪੇਜ ਇੱਥੋਂ ਲੈ ਸਕਦੇ ਹੋ ਹੈ ਪੈੱਨ ਲੈ ਸਕਦੇ ਹਾਂ ਡਾਇਰੀਸ ਅਲੱਗ ਅਲੱਗ ਤਰ੍ਹਾਂ ਦੀਆਂ ਮਿਲ ਜਾਂਦੀਆਂ ਨੋਟ ਬੁੱਕ ਛਪੀਆਂ ਹੋਈਆਂ ਮਿਲ ਜਾਂਦੀਆਂ ਜਿੱਥੇ ਰਾਹੀਂ ਤੁਸੀਂ ਆਪਣੀ ਕਲਾ ਕ੍ਰਿਤਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਸ਼ਿੰਗਾਰ ਦੇ ਹਾਂ ਅਤੇ ਮੇਰਾ ਇਹ ਸ਼ੌਕ ਵੀ ਹੈ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਕਲਾ ਕ੍ਰਿਤਾਂ ਖਰੀਦ ਕਿ ਆਪਣੀਆਂ ਜਿਹੜੀਆਂ ਰਚਨਾਵਾਂ ਨੂੰ ਚੰਗਾ ਰੂਪ ਦੇਣ ਦੀ ਕੋਸ਼ਿਸ਼ ਕਰਦੇ ਹਾਂ